ਹੈਲੋ ਹਾਂਜੀ ਫਲਿੱਪਕਾਰਟ ਤੋਂ ਬੋਲ ਰਹੇ ਹਾਂਜੀ ਮੈਂ ਇੱਕ ਔਡਰ ਫ਼ੋਨ ਕੀ ਦਾ ਫ਼ੋਨ ਔਡਰ ਕੀਤਾ ਸੀਗਾ ਵਿਕਰਮ ਤਿਵਾਰੀ ਹੈ ਮੇਰਾ ਨਾਮ ਪ੍ਰੇਮ ਨਗਰ ਤੋਂ ਉਹ ਔਡਰ ਮੈਨੂੰ ਮਿਲ ਗਿਆ ਸੀਗਾ ਟਾਈਮ ਨਾਲ ਅਤੇ ਬਹੁਤ ਹੀ ਵਧੀਆ ਤੁਸੀਂ ਸਰਵਿਸ ਪ੍ਰੋਵਾਈਡ ਕੀਤੀ ਮੈਨੂੰ ਔਨ ਦਾ ਟਾਈਮ ਆ ਗਿਆ ਸੀਗਾ ਪੈਕਿੰਗ ਬਹੁਤ ਵਧੀਆ ਕੀਤੀ ਵੀ ਸੀ ਤੁਸੀਂ ਬਿਲਕੁਲ ਇਕਦਮ ਸੇਫ ਪੈਕਿੰਗ ਸੀਗੀ ਵਿੱਦ ਬਬਲਸ ਮੈਂ ਖੋਲ੍ਹਿਆ ਬੜਾ ਅੱਛਾ ਸੀਗਾ ਫਸਟ ਟਾਈਮ ਮੈਂ ਫ਼ੋਨ ਲਿਆ ਔਨਲਾਈਨ ਕਦੀ ਪਹਿਲਾਂ ਕ ਪਰਚੇਜ਼ ਨਹੀਂ ਕੀਤਾ ਸੀਗਾ ਲੇਕਿਨ ਫਸਟ ਟਾਈਮ ਦਾ ਹੀ ਮੇਰਾ ਐਕਸਪੀਰੀਅਂਸ ਯਾਨੀ ਕਿ ਬਹੁਤ ਅੱਛਾ ਰਿਹਾ ਤੁਹਾਡੇ ਫ਼ੋਨ ਨਾਲ ਫ਼ੋਨ ਮੈਂ ਖੋਲ੍ਹਿਆ ਅੰਦਰ ਤੁਸੀਂ ਗਲਾਸ ਵੀ ਫ੍ਰੀ ਦਾ ਲਾਇਆ ਹੋਇਆ ਸੀਗਾ ਬਹੁਤ ਵਧੀਆ ਸੀਗਾ ਕਵਰ ਵੀ ਨਾਲ ਪ੍ਰੋਵਾਈਡ ਕੀਤਾ ਹੋਇਆ ਸੀ ਮੈਂ ਇਹ ਫ਼ੋਨ ਯਾਨੀ ਕਿ ਲਾਈਫ਼ ਦਾ ਪਹਿਲਾ ਫ਼ੋਨ ਆ ਜਿਹੜਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਆਜ ਨਾ ਮੇਰੇ ਫੈਮਲੀ ਮੈਂਬਰਸ ਕੋਲ ਹੈ ਨਾ ਹੀ ਮੇਰੇ ਫਰੈਂਡਸ ਕੋਲ ਇਹਦੇ ਨਾਲ ਦਾ ਫ਼ੋਨ ਸੀ ਅਤੇ ਫ ਮੈਂ ਚਲਾ ਕੇ ਵੀ ਦੇਖਿਆ ਉਹਨੂੰ ਔਨ ਕੀਤਾ ਉਹਦੀ ਡਿਸਪਲੇਅ ਬਹੁਤ ਵਧੀਆ ਹੈ ਪ੍ਰੋਸੈਸਿੰਗ ਬਹੁਤ ਵਧੀਆ ਉਹਦੀ ਪ੍ਰੋਸੈਸਰ ਬਹੁਤ ਵਧੀਆ ਲੱਗਿਆ ਵਾ ਉਹਦੇ ਵਿੱਚ ਤੁਹਾਡੀ ਸਰਵਿਸ ਵੱਲ ਦੇਖ ਕੇ ਮੈਨੂੰ ਯਾਨੀ ਦਿਲ ਕੀਤਾ ਕਿ ਮੈਂ ਤੁਹਾਨੂੰ ਫੀਡਬੈਕ ਦੇਵਾਂ ਕਿ ਮੇਰਾ ਐਕਸਪੀਰੀਅਂਸ ਜਿਹੜਾ ਫਸਟ ਟਾਈਮ ਹੈ ਔਨਲਾਈਨ ਪਰਚੇਜਿੰਗ ਦਾ ਬਹੁਤ ਵਧੀਆ ਰਿਹਾ ਹੈ ਤੁਹਾਡੇ ਨਾਲ ਆਸ ਕਰਦਾ ਹਾਂ ਕਿ ਇਨ ਫਿਊਚਰ ਮੈਂ ਤੁਹਾਡੇ ਕੋਲ ਹੋਰ ਵੀ ਇਲੈਕਟ੍ਰੋਨਿਕ ਸਮਾਨ ਲਊਂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ